ਮੈਂ ਆਪਣੇ ਸੰਪਾਦਨ ਅਤੇ ਸੰਸ਼ੋਧਨਾਂ ਨੂੰ ਸੰਭਾਲਣ ਲਈ ਬਹੁਤ ਤਰੀਕੇ ਦਾ ਪ੍ਰਬੰਧ ਬਹੁਤ ਤਰੀਕੇ ਦਾ ਯੂਜ ਕਰਦਾ ਹਾਂ ਜਿਨ੍ਹਾਂ ਦੇ ਵਿੱਚੋਂ ਕਿ ਅੱਜ ਦੇ ਟੈਮ ਦੇ ਵਿੱਚ ਮੇਰਾ ਸਾਥ ਦਿੰਦਾ ਮੇਰਾ ਫੋਨ ਮੇਰਾ ਮੋਬਾਈਲ ਫੋਨ ਮੈਂ ਆਪਣੇ ਮੋਬਾਈਲ ਫੋਨ ਦੇ ਵਿੱਚ ਬਹੁਤ ਤਰ੍ਹਾਂ ਦੇ ਰਿਕੋਡ ਵਗੈਰਾ ਫੋਨ ਨੰਬਰ ਬਹੁਤ ਸਾਰੇ ਡੌਕੂਮੈਂਟ ਨੂੰ ਸੰਭਾਲ ਕੇ ਰੱਖਦਾ ਹਾਂ ਜਿਨ੍ਹਾਂ ਦੇ ਵਿੱਚ ਜਿਹੜਾ ਕਿ ਇਸ ਤੋਂ ਇਲਾਵਾ ਮੈਂ ਆਪਣੇ ਕੰਪਿਊਟਰ ਦੇ ਵਿੱਚ ਬਹੁਤ ਸਾਰੇ ਚੀਜ਼ਾਂ ਨੂੰ ਡੋਕ ਐਜ ਅ ਡੌਕੂਮੈਂਟ ਬਣਾ ਕੇ ਫਾਈਲਾਂ ਬਣਾ ਕੇ ਸੰਭਾਲ ਕੇ ਰੱਖਦਾ ਹਾਂ ਇਸ ਤੋਂ ਇਲਾਵਾ ਮੈਂ ਆਪਣੀ ਕਾਪੀ ਕਿਤਾਬ ਕਾਪੀ ਦੇ ਵਿੱਚ ਕੁਛ ਚੀਜ਼ਾਂ ਜਿਹੜੀ ਮੈਨੂੰ ਬਹੁਤ ਜਿਹੜੀ ਬਹੁਤ ਜ਼ਰੂਰੀ ਹੁੰਦੀਆਂ ਹਨ ਉਨ੍ਹਾਂ ਨੂੰ ਲਿਖ ਕੇ ਰੱਖ ਲਿਖ ਕੇ ਸੰਭਾਲਦਾ ਹਾਂ ਮੈਂ ਅਲੱਗ ਇਸ ਤੋਂ ਇਲਾਵਾ ਵੀ ਹੋਰ ਤਰੀਕੇ ਨੇ ਜਿਨ੍ਹਾਂ ਦੇ ਵਿੱਚ ਮੈਂ ਆਪਣੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਚੀਜ਼ ਬਾਰੇ ਦੱਸ ਦਿੰਦਾ ਹਾਂ ਅਤੇ ਆਪਣੇ ਕਲੰਡਰ ਦੇ ਵਿੱਚ ਉਹ ਚੀਜ਼ਾਂ ਲਿਖ ਦਿੰਦਾ ਹਾਂ ਅਤੇ ਇਹੀ ਇਨ੍ਹਾਂ ਤਰੀਕਿਆਂ ਨਾਲ ਹੀ ਮੈਂ ਆਪਣੇ ਸੰਪਾਦਨ ਅਤੇ ਸੰਸ਼ੋਧਨਾਂ ਨੂੰ ਸੰਭਾਲ ਕੇ ਰੱਖਦਾ ਹਾਂ